ਜਿਵੇਂ ਕਿ ਮੇਰੇ ਦਾਦੇ ਪੜਦਾਦੇ ਉਨ੍ਹਾਂ ਤੋਂ ਹੀ ਬਾਗਬਾਨੀ ਚੱਲਦੀ ਆ ਰਹੀ ਹੈ ਜੀ ਅਤੇ ਮੈਨੂੰ ਵੀ ਸ਼ੌਕ ਬਚਪਨ ਤੋਂ ਹੀ ਪੈ ਗਿਆ ਕਿਉਂਕਿ ਦਾਦਾ ਜੀ ਸਾਨੂੰ ਦੱਸਦੇ ਹੁੰਦੇ ਸੀ ਇਨ੍ਹਾਂ ਦੇ ਫਾਇਦੇ ਵੀ ਕਿਵੇਂ ਕਿਵੇਂ ਆਪਾਂ ਦਰਖੱਤਾਂ 'ਚੋਂ ਵੀ ਆਪਾਂ ਕਮਾਈ ਦਾ ਸਾਧਨ ਬਣਾ ਸਕਦੇ ਹਾਂ ਅਤੇ ਕੁਦਰਤੀ ਤੌਰ 'ਤੇ ਵੀ ਇਹ ਬਹੁਤ ਵਧੀਆ ਇੱਕ ਏਜੰਡਾ ਪਲੇਅ ਕਰਦੀ ਹੈ ਜੀ ਅਤੇ ਜਿਸ ਨਾਲ ਕੁਦਰਤ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਦੇਖਿਆ ਜਾਵੇ ਬਹੁਤ ਹੀ ਘੱਟ ਜੋ ਦਰੱਖਤ ਰਹਿ ਗਏ ਹਨ ਪਹਿਲਾਂ ਚਾਰੇ ਪਾਸੇ ਆਪਣਾ ਦਰੱਖਤ ਹੀ ਦਰੱਖਤ ਹੁੰਦੇ ਸਨ ਜਦੋਂ ਮੈਂ ਛੋਟਾ ਹੁੰਦਾ ਸੀ ਮੈਨੂੰ ਯਾਦ ਹੈ ਜਦੋਂ ਜਦੋਂ ਜਿਉਂ ਜਿਉਂ ਵੱਡਾ ਹੋਈ ਗਿਆ ਇਉਂ ਇਉਂ ਅਸੀਂ ਦੇਖਿਆ ਹੈ ਕਈ ਦਰੱਖਤ ਵੱਢ ਦਿੱਤੇ ਗਏ ਹਨ ਜੰਗਲ ਹੁੰਦੇ ਸੀਗੇ ਉਹ ਵੱਢ ਦਿੱਤੇ ਹਨ ਰੋਡ ਨਿਕਲ ਗਏ ਹਨ ਵਿੱਚ ਨੂੰ ਅਤੇ ਆਪਣਾ ਲੋਕਾਂ ਨੇ ਮਕਾਨ ਪਾ ਲਏ ਹਨ ਵਾਦੀਆਂ ਹੁੰਦੀਆਂ ਸੀਗੀਆਂ ਉੱਥੇ ਦਰੱਖਤ ਲਾਏ ਹੁੰਦੇ ਸੀ ਲੋਕਾਂ ਨੇ ਪੁਰਾਣੇ ਬਾਬਿਆਂ ਨੇ ਜੀ ਹੁਣ ਨਵੇਂ ਹੁਣ ਜਿਹੜੇ ਜਵਾਕ ਆਉਂਦੇ ਹਨ ਉਹ ਕਹਿੰਦੇ ਕੋਠੀ ਪਾਉਣੀ ਹੈ ਪਾਪਾ ਕੋਠੀ ਪਾਉਣੀ ਹੈ ਫਿਰ ਉਹ ਦਰੱਖਤਾਂ ਦਾ ਬਲੀਦਾਨ ਦੇ ਦਿੰਦੇ ਹਨ ਵੱਢ ਦਿੰਦੇ ਹਨ ਉਹ ਕਿਤੇ ਨਾ ਕਿਤੇ ਕੁਦਰਤ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ ਅਤੇ ਮੈਨੂੰ ਸਭ ਤੋਂ ਜ਼ਿਆਦਾ ਚੀਜ਼ ਨੇ ਪ੍ਰੇਰਿਤ ਕੀਤਾ ਜਦੋਂ ਮੈਂ ਸਕੂਲ 'ਚ ਸੀ ਅਤੇ ਸਾਡੇ ਕਲਾਸ ਲੱਗਦੀ ਹੁੰਦੀ ਸੀ ਇੰਨਵਾਇਰਮੈਂਟਲ ਇੰਨਵਾਇਰਮੈਂਟ ਦੀ ਕਲਾਸ ਲੱਗਦੀ ਹੁੰਦੀ ਸੀ ਜਿਸ ਵਿੱਚ ਸਾਨੂੰ ਦੱਸਿਆ ਜਾਂਦਾ ਸੀ ਵੀ ਕਿਵੇਂ ਆਪਾਂ ਕੁਦਰਤ ਨੂੰ ਬਚਾ ਸਕਦੇ ਹਨ ਅਤੇ ਕਿਹੜੇ ਕਿਹੜੇ ਤਰੀਕੇ ਹਨ ਦਰੱਖਤ ਵੱਧ ਤੋਂ ਵੱਧ ਲਾਉ ਪਾਣੀ ਨਾ ਵੇਸਟ ਕਰੋ ਬਾਗਬਾਨੀ ਵਿੱਚ ਕਿਹੜੇ ਦਰੱਖਤਾਂ ਦਾ ਮਤਲਬ ਜਿਨ੍ਹਾਂ ਦਾ ਜ਼ਿਆਦਾ ਫਾਇਦਾ ਹੁੰਦਾ ਹੈ ਜਿਵੇਂ ਵੱਡੇ ਦਰੱਖਤ ਹੁੰਦੇ ਹਨ ਉਹ ਫਲ਼ ਵੀ ਦਿੰਦੇ ਹਨ ਅਤੇ ਪਲਿਊਸ਼ਨ ਕਾਰਬੋਨ ਡਾਈਆਕਸਾਈਡ ਵੀ ਜ਼ਿਆਦਾ ਸੋਖਦੇ ਹਨ ਜਿਵੇਂ ਕਿ ਅੰਬ ਹੋ ਗਿਆ ਨਿੰਮ ਹੋ ਗਈ ਅਤੇ ਹੋਰ ਬਾਕੀ ਜਿਵੇਂ ਬੋਹੜ ਹੋ ਗਿਆ ਜੀ ਅਤੇ ਆਪਣੇ ਆੜੂ ਹੋ ਗਏ ਜੀ ਅਤੇ ਆਪਣੇ ਇਹ ਜਾਮਣ ਹੋ ਗਈ ਜਾਮਣ ਅਤੇ ਜਮ ਜਾਮਣ ਦੇ ਅਤੇ ਫਾਇਦੇ ਹੀ ਬਹੁਤ ਹਨ ਜਿਵੇਂ ਕਿ ਸ਼ੂਗਰ ਮਿਟਾਉਂਦੀ ਹੈ ਜੀ ਹੈ ਨਾ ਅਤੇ ਬਾਗਬਾਨੀ ਦਾ ਤਾਂ ਸਾਨੂੰ ਸ਼ੁਰੂ ਤੋਂ ਹੀ ਸ਼ੌਕ ਪੈ ਗਿਆ ਸੀ ਅਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਲੋਕਾਂ ਨੂੰ ਵੀ ਅੱਗੇ ਵਧੋ ਤੁਸੀਂ ਵੀ ਖਾਲੀ ਜਗ੍ਹਾ 'ਤੇ ਆਪਣੇ ਘਰਾਂ 'ਚ ਆਪਣੇ ਵਾੜਿਆਂ 'ਚ ਜਿੱਥੇ ਵੀ ਖਾਲੀ ਜਗ੍ਹਾ ਆਪਣੇ ਖੇਤਾਂ 'ਚ ਵੱਧ ਤੋਂ ਵੱਧ ਦਰੱਖਤਾਂ ਦਾ ਨਿਰਮਾਣ ਉੱਥੇ ਦਰੱਖਤ ਲਾਉ ਤਾਂ ਕਿ ਕੁਦਰਤ ਨੂੰ ਆਉਣ ਵਾਲੇ ਸ ਪੀੜ੍ਹੀਆਂ ਲਈ ਬਚਾਇਆ ਜਾ ਸਕੇ